ਧਾਰਮਿਕ ਖੇਤਰ ਵਿੱਚ ਲੋਕ ਆਪਣੇ ਪੀੜ੍ਹੀ ਨੂੰ ਅੱਗੇ ਵਧਾਉਣ ਲਈ ਅੱਗੇ ਸਿੱਖਿਆ ਦੇਣ ਲਈ ਉਹਨਾਂ ਨੂੰ ਉਸ ਪੀੜ੍ਹੀ ਸਿੱਖਿਆ ਬਾਰੇ ਧਰਮ ਸਥਾਨਾਂ 'ਤੇ ਲੈ ਕੇ ਜਾਂਦੇ ਹਨ ਉੱਥੇ ਦਾ ਇਤਿਹਾਸਿਕ ਦੱਸਦੇ ਹਨ ਕਿ ਇੱਥੇ ਆਹ ਕੁਛ ਜੋ ਹੋਇਆ ਕਿਵੇਂ ਇੱਥੇ ਜੋਤੀ ਸਰੂਪ ਗੁਰਦੁਆਰਾ ਸਾਡਾ ਉੱਥੇ ਛੋਟੇ ਸਾਹਿਬਾਦਿਆਂ ਸਾਹਿਬਜ਼ਾਦਿਆਂ ਬਾਰੇ ਦੱਸਿਆ ਜਾਂਦਾ ਹੈ ਜਾਂ ਫੇਰ ਹੋਰ ਵੀ ਬਹੁਤ ਧਾਰਮਿਕ ਸਥਾਨ ਹਨ ਜਿੱਥੇ ਜਿੱਥੇ ਵੀ ਧਾਰਮਿਕ ਸਥਾਨ ਹਨ ਉੱਥੇ ਉੱਥੇ ਅਸੀਂ ਆਪਣੇ ਬੱਚਿਆਂ ਨੂੰ ਲੈ ਕੇ ਜਾਂਦੇ ਹਾਂ ਅਤੇ ਉਹਨਾਂ ਨੂੰ ਉੱਥੇ ਦੀ ਇਤਿਹਾਸਕ ਬਾਰੇ ਦਾ ਜਾਣੂ ਕਰਾਉਂਦੇ ਹਾਂ ਤਾਂ ਕਿ ਸਾਡੀ ਪੀੜ੍ਹੀ ਆ ਆਉਣ ਵਾਲੀ ਪੀੜ੍ਹੀ ਨੂੰ ਸਾਡੇ ਸਿੱਖ ਇਤਿਹਾਸ ਬਾਰੇ ਗਿਆਨ ਹੋਵੇ